ਮੇਰੀ ਅਜਿਹੇ ਵਿਅਕਤੀ ਨੂੰ ਇਹ ਸਲਾਹ ਹੈ ਕਿ ਜੇ ਉਸਨੇ ਗਾਣਾ ਸ਼ੁਰੂ ਕਰਨਾ ਹੈ ਜਾਂ ਆਪਣੇ ਗਾਣੇ ਦੇ ਹੁਨਰ ਨੂੰ ਸੁਧਾਰਨਾ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਆਪਣੇ ਲਈ ਕੋਈ ਚੰਗਾ ਗੁਰੂ ਧਾਰਨਾ ਪਵੇਗਾ ਜੋ ਕਿ ਸੰਗੀਤ ਦਾ ਚੰਗਾ ਪਾਰਖੂ ਹੋਵੇ ਅਤੇ ਸੰਗੀਤ ਦਾ ਮਾਹਿਰ ਹੋਵੇ ਅਤੇ ਉਹਨੂੰ ਸੁਰਾਂ ਦੀ ਪੂਰੀ ਜਾਣਕਾਰੀ ਹੋਵੇ ਐਸੇ ਹੀ ਇਨਸਾਨ ਨੂੰ ਗੁਰੂ ਧਾਰਨਾ ਚਾਹੀਦਾ ਹੈ ਤਾਂ ਉਹ ਆਪਣਾ ਗਾਇਕੀ ਦਾ ਸਫਰ ਸ਼ੁਰੂ ਕਰ ਸਕਦਾ ਹੈ ਅਤੇ ਆਪਣੇ ਗਾਣੇ ਨੂੰ ਸੁਧਾਰ ਸਕਦਾ ਹੈ